ਇੱਕ ਛੇ ਉੱਨੀ ਸੌ ਪੈਂਹਠ ਚਾਰ ਛੇ ਉੱਨੀ ਸੌ ਚੁਰਾਸੀ ਉੱਨੀ ਬਾਰਾਂ ਉੱਨੀ ਸੌ ਬਾਨਵੇਂ ਚਾਰ ਅੱਠ ਉੱਨੀ ਸੌ ਛਿਆਨਵੇਂ ਚਾਰ ਚਾਰ ਦੋ ਹਜ਼ਾਰ ਤੇਈ